ਪਹਿਲੇ ਜ਼ਮਾਨੇ ਦੇ ਵਿੱਚ ਸਿਰਫ ਰੇਡੀਓ ਹੀ ਹੁੰਦੇ ਸਨ ਅਤੇ ਲੋਕ ਰੇਡੀਓ 'ਤੇ ਰੇਡੀਓ ਨੂੰ ਦੇ ਵਿੱਚ ਹੀ ਗਾਣਾ ਸੁਣਨਾ ਅਤੇ ਖਬਰਾਂ ਸੁਣਦੇ ਸਨ ਅੱਜ ਕੱਲ੍ਹ ਨਵੇਂ ਤਕਨੀਕੀ ਯੁਗ ਆ ਰਿਹਾ ਆ ਗਿਆ ਹੈ ਅਤੇ ਹੁਣ ਹਰ ਇੱਕ ਕੋਲ ਮੋਬਾਇਲ ਹਨ ਜਿਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੈਨਲ ਚਲਾਉਣਾ ਹੋਵੇ ਉਹ ਚੱਲਦਾ ਹੈ ਅਤੇ ਲੋਕ ਯੂਟਿਊਬ 'ਤੇ ਅਤੇ ਬਾਕੀ ਹੋਰ ਚੈਨਲਾਂ 'ਤੇ ਜਿਸ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਿਸੇ ਨੇ ਖਬਰਾਂ ਸੁਣਨੀਆਂ ਨੇ ਜਾਂ ਕੋਈ ਗਾਣੇ ਸੁਣਨੇ ਨੇ ਜਾਂ ਕੁਛ ਵੀ ਹੋਰ ਦੇਖਣਾ ਹੈ ਉਹ ਦੇਖ ਲੈਂਦੇ ਹਨ ਅਤੇ ਯੂਟਿਊਬ 'ਤੇ ਜਿਸ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਦੇਖਣੀ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਯੂਟਿਊਬ 'ਤੇ ਸਭ ਕੁਛ ਪਤਾ ਲੱਗ ਜਾਂਦਾ ਹੈ ਇਸ ਲਈ ਅੱਜ ਕੱਲ੍ਹ ਲੋਕ ਜ਼ਿਆਦਾਤਰ ਮੋਬਾਇਲਾਂ ਨੂੰ ਹੀ ਯੂਜ਼ ਕਰਦੇ ਹਨ ਅਤੇ ਮੋਬਾਇਲਾਂ 'ਤੇ ਹੀ ਖਬਰਾਂ ਸੁਣਦੇ ਹਨ